ਹੈਲੋ ਸਤਿ ਸ਼੍ਰੀ ਅਕਾਲ ਜੀ ਏਕਮ ਸਿੰਘ ਬੋਲਦੇ ਜੀ ਸਰ ਮੈਨੂੰ ਮੇਰੇ ਦੋਸਤ ਨੇ ਨੰਬਰ ਦਿੱਤਾ ਆਪ ਦਾ ਜੀ ਅਤੇ ਉਸਨੇ ਦੱਸਿਆ ਜੀ ਵੀ ਇੱਥੇ ਮੈਂ ਦਿੱਲੀ ਤੋਂ ਆ ਰਿਹਾ ਜੀ ਅਤੇ ਇਹ ਮੈਂ ਖਾਣੇ ਬਾਰੇ ਪਤਾ ਕਰਨਾ ਇੱਥੇ ਕਿਹੜੇ ਕਿਹੜੇ ਮਸ਼ਹੂਰ ਖਾਣੇ ਨੇ ਕਿੱਥੇ ਕਿੱਥੇ ਕੁ ਹੈਗੇ ਨੇ ਕੀ ਕੀ ਇਨ੍ਹਾਂ ਦੇ ਪ੍ਰਾਈਜ਼ ਹੈ ਜੀ

ਅਤੇ ਇਹ ਕਿੱਥੇ ਨੇ ਜੀ ਇਹ ਕਿ ਅਸੀਂ ਹਫਤੇ ਲਈ ਟੂਰ ਬਣਾਇਆ ਅਤੇ ਇੱਧਰਲਾ ਉਹ ਇਸ ਤੋਂ ਬਾਅਦ ਹੋ ਕੇ ਫਿਰ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣਾ ਉੱਧਰਲਾ ਕੋਈ ਹੈਗਾ ਇਸ ਤਰ੍ਹਾਂ ਦਾ ਕੋਈ ਰਸਤੇ 'ਚ ਜੇ ਕੋਈ ਹੋਰ ਲਵੇ ਲਾਉਣੇ ਅੱਛਾ ਜੀ ਸਾਡਾ ਯੂਟਿਊਬ ਚੈਨਲ ਸਾਡਾ ਯੂਟਿਊਬ ਚੈਨਲ ਆ ਮੈਂ ਵੀਡੀਓ ਬਣਾਉਣੀ ਆ ਜੀ ਨਾਲ ਵੀ ਜੀ ਹਾਂ ਠੀਕ ਹੈ ਜੀ ਅਤੇ ਇਹਨਾਂ ਦੇ ਰੇਟ ਰੇਟ ਕੀ ਹੋਣਗੇ ਜੀ ਪਤਾ ਕੁਛ ਮਾੜਾ ਮੋਟਾ ਠੀਕ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੁੰ ਆ ਤੁਹਾਨੂੰ ਆਵਾਂਗੇ ਜਦੋਂ ਆਵਾਂਗੇ ਤੁਹਾਨੂੰ ਕਾਲ ਕਰਾਂਗੇ ਅਤੇ ਤੁਹਾਨੂੰ ਰਸੀਵ ਕਰਕੇ ਪਹੁੰਚਾਂਗੇ ਠੀਕ